ਪੰਜਾਬ ਵਿੱਚ ਆਪਣੇ ਇਤਿਹਾਸ ਵਿੱਚ ਕਈ ਚੁਣੌਤੀਆਂ ਦਾ ਟਾਕਰਾ ਹੋਇਆ ਜਿਵੇਂ ਕਿ ਉੱਨੀ ਸੌ ਸੰਤਾਲ਼ੀ ਦੀ ਵੰਡ ਵਿੱਚ ਪੰਜਾਬ ਨੂੰ ਕਈ ਹਿੱਸਿਆਂ ਵਿੱਚ ਵੰਡਿਆ ਗਿਆ ਠੀਕ ਆ ਜੋ ਕਿ ਥੋੜ੍ਹਾ ਜਿਹਾ ਪੰਜਾਬ ਪਾਕਿਸਤਾਨ ਵਿੱਚ ਅਤੇ ਥੋੜ੍ਹਾ ਜਿਹਾ ਇੰਡੀਆ ਵਿੱਚ ਆ ਗਿਆ ਠੀਕ ਆ ਜਦੋਂ ਪੰਜਾਬ ਦੀ ਵੰਡ ਹੋਈ ਤਾਂ ਪੰਜਾਬ ਨੂੰ ਵ ਪੰਜਾਬ ਦੇ ਹੋਰ ਕਈ ਹਿੱਸਿਆਂ ਨੂੰ ਹਿੱਸਿਆਂ ਵਿੱਚ ਵੰਡਿਆ ਗਿਆ ਇੱਕ ਹਰਿਆਣੇ 'ਚ ਚਲਾ ਗਿਆ ਇੱਕ ਇੱਕ ਹਿਮਾਚਲ ਚਲ ਗਿਆ ਠੀਕ ਆ ਪੰਜਾਬ ਪੰਜਾਬ ਦੇ ਅੱਜ ਵੀ ਪੰਜਾਬ ਦੀ ਜਿਹੜੀ ਸਰਹੱਦ ਆ ਉਹ ਕੁਝ ਕੁ ਪਾਕਿਸਤਾਨ ਅਤੇ ਕੁਝ ਕੁ ਪੰਜਾਬ 'ਚ ਆ ਜਿਸ ਪਿੱਛੇ ਅਕਸਰ ਹੀ ਕਈ ਤਰ੍ਹਾਂ ਦੀਆਂ ਲੜਾਈਆਂ ਹੁੰਦੀਆਂ ਰਹਿੰਦੀਆਂ ਹਨ